ਹਾਂਜੀ ਮੇਰਾ ਪੱਕਾ ਵਿਸ਼ਵਾਸ ਹੈ ਕਿ ਭੰਗੜਾ ਐਰੋਬਿਕਸ ਇੱਕ ਸ਼ਾਨਦਾਰ ਸ਼ਰੀਰਿਕ ਗਤੀਵਿਧੀ ਹੈ ਅਤੇ ਇਹ ਸਿਰਫ ਮਨੋਰੰਜਨ ਸਾਧਨ ਹੀ ਨਹੀਂ ਸਗੋਂ ਸਰੀਰਕ ਅਤੇ ਮਾਨਸਿਕ ਸਿਹਤ ਲਈ ਇੱਕ ਬਹੁਤ ਹੀ ਲਾਭਦਾਇਕ ਕਸਰਤ ਵੀ ਹੈ ਮੇਰੇ ਵਿਚਾਰ ਵਿੱਚ ਭੰਗੜਾ ਐਰੋਬਿਕਸ ਨੂੰ ਇੱਕ ਸੰਪੂਰਨ ਕਸਰਤ ਦੇ ਰੂਪ ਵਿੱਚ ਦੇਖਿਆ ਜਾ ਸਕਦਾ ਹੈ ਜੋ ਕਿ ਸਰੀਰ ਅਤੇ ਦਿਮਾਗ ਦੋਵਾਂ ਨੂੰ ਲਾਭ ਪਹੁੰਚਾਉਂਦੇ ਹਨ ਜਿਵੇਂ ਕਿ ਭੰਗੜਾ ਅਸੀਂ ਜਾਣਦੇ ਹਾਂ ਇੱਕ ਬਹੁਤ ਹੀ ਊਰਜਾਵਾਨ ਨਾਚ ਰੂਪ ਹੈ ਜਿਸ ਵਿੱਚ ਤੇਜ਼ ਰਫਤਾਰ ਵਾਲੀਆ ਹਰਕਤਾਂ ਸ਼ਾਮਿਲ ਵੀ ਹੁੰਦੀਆਂ ਹਨ ਜਿਵੇਂ ਕਿ ਛਾਲਾ ਮਾਰਨਾ ਘੁੰਮਣਾ ਉੱਚੀ ਆਵਾਜ਼ ਵਿੱਚ ਨੱਚਣਾ ਅਤੇ ਹੱਥਾਂ ਅਤੇ ਪੈਰਾਂ ਨੂੰ ਤੇਜ਼ੀ ਤੇਜ਼ੀ ਨਾਲ ਹਿਲਾਉਣਾ ਇਹ ਸਾਰੀਆਂ ਹਰਕਤਾਂ ਦਿਲ ਦੀ ਧੜਕਣ ਨੂੰ ਵਧਾਉਂਦੀਆਂ ਹਨ ਅਤੇ ਸਰੀਰ ਨੂੰ ਗਰਮ ਕਰਦੀਆਂ ਹਨ ਜਿਸ ਨਾਲ ਕੈਲੋਰੀ ਵਰਨ ਹੁੰਦੀਆਂ ਹਨ ਅਤੇ ਭਾਰ ਘਟਾਉਣ ਵਿੱਚ ਬਹੁਤ ਹੀ ਮਦਦ ਮਿਲਦੀ ਹੈ ਇਸ ਲਈ ਭੰਗੜਾ ਐਰੋਬਿਕਸ ਇੱਕ ਸ਼ਾਨਦਾਰ ਕਾਰਡੀਓ ਕਸਰਤ ਹੈ ਜੋ ਦਿਲ ਦੀ ਸਿਹਤ ਨੂੰ ਸੁਧਾਰਨ ਖੂਨ ਦੇ ਦੌਰੇ ਨੂੰ ਵਧਾਉਣ ਅਤੇ ਸਮੁੱਚੀ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਬਹੁਤ ਹੀ ਜਿਆਦਾ ਮਦਦ ਕਰ ਸਕਦੀ ਹੈ ਇਸ ਤੋਂ ਇਲਾਵਾ ਭੰਗੜਾ ਐਰੋਬਿਕਸ ਸਰੀਰ ਦੀ ਤਾਕਤ ਅਤੇ ਲਚਕਤਾ ਨੂੰ ਵੀ ਵਧਾਉਂਦਾ ਹੈ ਭੰਗੜੇ ਦੀਆਂ ਵਿਭਿੰਨ ਹਰਕਤਾਂ ਸਰੀਰ ਦੀਆਂ ਵੱਖ ਵੱਖ ਮਾਸਪੇਸ਼ੀਆਂ ਨੂੰ ਸ਼ਾਮਿਲ ਕਰ ਦਿੰਦੀਆਂ ਹਨ ਜਿਸ ਨਾਲੋਂ ਬਹੁਤ ਹੀ ਮਜਬੂਤ ਹੁੰਦੀਆਂ ਹਨ ਅਤੇ ਸਰੀਰ ਨੂੰ ਟੋਨ ਕਰਨ ਵਿੱਚ ਮਦਦ ਮਿਲਦੀ ਹੈ ਇਹ ਨਾਚ ਸਰੀਰ ਦੀ ਲਚਕਤਾ ਨੂੰ ਵੀ ਵਧਾਉਂਦਾ ਹੈ ਕਿਉਂਕਿ ਇਸ ਵਿੱਚ ਬਹੁਤ ਸਾਰੀਆਂ ਖਿੱਚਣ ਵਾਲੀਆਂ ਹਰਕਤਾਂ ਸ਼ਾਮਿਲ ਹੁੰਦੀਆਂ ਹਨ ਜੋ ਕਿ ਜਿਸ ਤਰ੍ਹਾਂ ਲਚਕਦਾਰ ਬਣਾਉਂਦੀਆਂ ਹਨ ਅਤੇ ਸੱਟ ਲੱਗਣ ਦੇ ਖਤਰੇ ਨੂੰ ਘਟਾਉਂਦੀਆਂ ਹਨ ਭੰਗੜਾ ਐਰੋਬਿਕਸ ਮਾਨਸਿਕ ਸਿਹਤ ਲਈ ਵੀ ਬਹੁਤ ਹੀ ਫਾਇਦੇਮੰਦ ਹਨ ਇਹ ਤਨਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਬਹੁਤ ਮਦਦ ਕਰਦਾ ਹੈ ਕਿਉਂਕਿ ਨਾਚ ਕਰਦੇ ਸਮੇਂ ਸਰੀਰ ਐਰੋ ਐਬਲੋਹਿਨ ਨਾਮਕ ਰਸਾਇਨ ਛੱਡਦਾ ਹੈ ਜਿੱਦਾਂ ਕਿ ਪਸੀਨਾ ਜੋ ਕਿ ਕੁਦਰਤੀ ਮੂੜ ਹੋਸਟਰ ਹਨ ਅਤੇ ਖੁਸ਼ੀ ਦੀ ਭਾਵਨਾ ਪੈਦਾ ਕਰਦੇ ਹਨ ਇਸ ਤੋਂ ਇਲਾਵਾ ਭੰਗੜਾ ਇੱਕ ਸਮਾਜਿਕ ਗਤੀਵਿਧੀ ਹੈ ਜੋ ਲੋਕਾਂ ਨੂੰ ਇੱਕ ਦੂਜੇ ਨਾਲ ਜੁੜਨ ਅਤੇ ਮਜੇ ਕਰਨ ਦਾ ਮੌਕਾ ਪ੍ਰਧਾਨ ਕਰਦੀ ਹੈ ਇਹ ਸਮਾਜਿਕ ਤੌਰ ਤੇ ਮਿਲਣ ਅਤੇ ਦੋਸਤ ਬਣਾਉਣ ਦਾ ਇੱਕ ਵਧੀਆ ਤਰੀਕਾ ਹੈ ਜੋ ਇਕੱਲੇਪਨ ਅਤੇ ਸਮਾਜਿਕ ਅਲੱਗ ਥਲਗਤਾਂ ਦੀਆਂ ਭਾਵਨਾਵਾਂ ਨੂੰ ਘਟਾਉਣ ਵਿੱਚ ਬਹੁਤ ਹੀ ਜਿਆਦਾ ਮਦਦ ਕਰ ਸਕਦਾ ਹੈ